ਮੈਂ ਜਦੋਂ ਸਕੂਲ ਦੇ ਵਿੱਚ ਪਲਸ ਟੂ ਜਮਾਤ ਦੇ ਵਿੱਚ ਪੜ੍ਹਦੀ ਸੀ ਤਾਂ ਉਦੋਂ ਮੈਂ ਡਰਾਇੰਗ ਵੀ ਰੱਖੀ ਹੋਈ ਸੀਗੀ ਕਲਾਸ ਅਤੇ ਮੇਰੀ ਡਰੋਇੰਗ ਦਾ ਸਬਜੈਕਟ ਮੈਂ ਰੱਖਿਆ ਹੋਇਆ ਸੀ ਉਹਦੇ ਵਿੱਚ ਸਾਨੂੰ ਇੱਕ ਵਾਰ ਸਾਡਾ ਪ੍ਰੈ ਪ੍ਰੈਕਟੀਕਲ ਹੋਇਆ ਸੀ ਸਾਰੇ ਬੱਚਿਆਂ ਦਾ ਸਾਡੇ ਮੈਡਮ ਨੇ ਸਾਡੇ ਸਾਹਮਣੇ ਫੁੱਲ ਅਤੇ ਸੇਬ ਦੇ ਫਰੂਟ ਜਿਹੜੇ ਫੁੱਲ ਸੇਬ ਕੇਲੇ ਵਗੈਰਾ ਰੱਖਦੇ ਸੀਗੇ ਅਤੇ ਉਹਨਾਂ ਨੇ ਕਿਹਾ ਸੀਗਾ ਇਹਨੂੰ ਤੁਸੀਂ ਆਪਣੀ ਡਰਾਇੰਗ 'ਤੇ ਉਤਾਰੋ ਉਸਨੂੰ ਉਤਾਰਨ ਲਈ ਸਾਨੂੰ ਕਈ ਸਾਰੀ ਪੈਨਸਿਲਾਂ ਪੇਂਟਿੰਗਸ ਦਿੱਤੀਆਂ ਗਈਆਂ ਸਨ ਅਤੇ ਛੋਟੇ ਤੋਂ ਛੋਟੀ ਚੀਜ਼ ਜਿਵੇਂ ਉਹਦੀ ਸ਼ੈਡੋ ਹੋ ਗਈ ਉਸ ਉਹ ਸੇਬ ਦੀ ਕੇਲਿਆਂ ਦੀ ਅਤੇ ਫਲ਼ਾ ਫੁੱਲਾਂ ਦੀ ਉਹਨੂੰ ਉਤਾਰਨ ਲਈ ਅਸੀਂ ਟਾ ਲਾਈਟ ਪੈਨਸਿਲ ਪਹਿਲਾਂ ਸ਼ੂ ਯੂਜ ਕਰ ਵਰਤਦੇ ਸੀਗੇ ਫਿਰ ਅਸੀਂ ਜਿਹੜੀ ਉਹਨੂੰ ਰੰਗ ਦੇਣ ਲਈ ਅਸੀਂ ਉਹਦੇ ਕਲਰ ਯੂਜ ਕਰਦੇ ਸੀਗੇ ਪੈਨਸਿਲ ਕਲਰਸ ਹੋ ਗਏ ਜਾਂ ਪੈਂਸਲ ਕਲਰਸ ਹੋ ਗਏ ਜਾਂ ਸ਼ੇਡਿੰਗ ਕਲਰਸ ਹੋ ਗਏ ਉਹ ਯੂਜ ਕਰਦੇ ਸੀ ਸ਼ੇਡਿੰਗ ਦੇਣ ਲਈ ਉਹਨੂੰ ਅਤੇ ਅਸੀਂ ਅਲੱਗ ਅਲੱਗ ਕਲਰ ਯੂਜ ਕਰਦੇ ਸੀ ਜੇ ਅਗਰ ਸੇਬ ਦਾ ਰੰਗ ਇੱਕ ਸਾਈਡ ਲਾਲ ਆ ਇਕ ਸਾਈਡ ਪੀਲਾ ਤਾਂ ਉਹ ਯੂਜ ਕਰਦੇ ਸੀ ਬਨਾਨਾ ਦਾ ਇੱਕ ਸਾਈਡ ਅਗਰ ਪੀ ਪੀਲਾ ਹੈ ਤਾਂ ਦੂਜੀ ਸਾਈਡ ਵਿੱਚ ਵੀ ਥੋੜ੍ਹੀ ਜਿਹੀ ਕਾਲਾਪਨ ਹੈ ਤਾਂ ਉਹ ਈ ਪੀਲਾ ਅਤੇ ਕਾਲਾ ਰੰਗ ਅਸੀ ਯੂਜ ਕਰਦੇ ਸੀ